ਹਾਂ ਮੈਂ ਇੱਕ ਵਾਰੀ ਰਾਸ਼ਟਰੀ ਆਰਟ 'ਚ ਮੈਂ ਹਿੱਸਾ ਲਿਤਾ ਸੀ ਜੋ ਕਿ ਮੈਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਂਕ ਸੀ ਅਤੇ ਮੈਂ ਪੇਂਟਿੰਗ ਆਪਣੇ ਸਕੂਲ ਟਾਈਮ 'ਤੇ ਮੈਂ ਪੇਂਟਿੰਗ 'ਚ ਪ੍ਰਾਈਜ ਵੀ ਪ੍ਰਾਈਜ ਵੀ ਜਿੱਤੀ ਹੋਈ ਆ ਤੇ ਮੇਰੇ ਇੱਕ ਵਾਰ ਮੈਂ ਪ੍ਰਿੰਸੀਪਲ ਜਦੋਂ ਉਹਨੇ ਮੇਰੀ ਪੇਂਟਿੰਗ ਦੇਖੀ ਤਾਂ ਉਹ ਖੁਸ਼ ਹੋ ਕੇ ਉਹਨੇ ਮੈਨੂੰ ਨੈਸ਼ਨਲ ਰਾਸ਼ਟਰੀ ਨੈਸ਼ਨਲ ਲੈਵਲ 'ਤੇ ਜਾਣ ਨੂੰ ਮੈਨੂੰ ਕਿਹਾ ਸੀ ਅਤੇ ਮੈਂ ਉੱਥੇ ਗਈ ਵੀ ਸੀ ਅਤੇ ਉਹਨੇ ਮੇਰੀ ਜਦੋਂ ਪੇਂਟਿੰਗ ਦੇਖੀ ਪ੍ਰਿੰਸੀਪਲ ਮੈਮ ਨੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗੀ ਮੇਰੀ ਪੇਂਟਿੰਗ ਅਤੇ ਉਹਨਾਂ ਨੇ ਮੈਨੂੰ ਫਿਰ ਨੈਸ਼ਨਲ ਲੈਵਲ 'ਚ ਭੇਜਿਆ ਅਤੇ ਉੱਥੇ ਮੈਂ ਹਿੱਸਾ ਲਿੱਤਾ ਸੀ ਆਪਣੀ ਪੇਂਟਿੰਗ ਮੁਕਾਬਲੇ 'ਚ ਅਤੇ ਜਦੋਂ ਮੈਂ ਉੱਥੇ ਗਈ ਮੈਨੂੰ ਹੋਰ ਵੀ ਬਹੁਤ ਚੀਜ਼ਾਂ ਦੀ ਨੌਲੇਜ ਮਿਲੀ ਕਈ ਉੱਥੇ ਜਦੋਂ ਮੈਂ ਗਈ ਅਤੇ ਉੱਥੇ ਕਈ ਸਟੇਟ ਦੇ ਬੱਚੇ ਆਏ ਹੋਏ ਸੀ ਜਿਨ੍ਹਾਂ ਨਾਲ ਮੇਰਾ ਕੋਂਪਟੀਸ਼ਨ ਹੋਇਆ ਉੱਥੇ ਉਹਨਾਂ ਨੇ ਕਈ ਤਰ੍ਹਾਂ ਦੀ ਪੇਂਟਿੰਗਸ ਬਣਾਈ ਜੋੋ ਕਿ ਮੈਂ ਵੀ ਦੇਖ ਕੇ ਮੈਨੂੰ ਵੀ ਵਧੀਆ ਲੱਗਿਆ ਮੈਂ ਉਹਨਾਂ ਦੇ ਨਾਲ ਪੇਂਟਿੰਗਸ 'ਤੇ ਨੌਲੇਜ ਮਿਲੀ ਮਿਲੀ ਮੈਨੂੰ ਨਾਲ ਨਾਲ ਉਹਨਾਂ ਦੇ ਕਲਚਰ ਦੀ ਵੀ ਮੈਨੂੰ ਨੌਲੇਜ ਮਿਲੀ ਕਲਚਰ ਬਾਰੇ ਵੀ ਮੈਂ ਉਹਨਾਂ ਨੂੰ ਜਾਣਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਗੱਲ ਚੰਗੀ ਹੋ ਜਾਏ ਕਿੱਦਾਂ ਦਾ ਸੀ ਕਿੱਦਾਂ ਦਾ ਰਹਿਣਾ ਸੈ ਖਾਣਾ ਪੀਣਾ ਸਭ ਕੁਝ ਸੀ ਮੈਂ ਜਦੋਂ ਆਪ ਨੈਸ਼ਨਲ ਗੁਜਰਾਤ ਗਈ ਸੀ ਗੁਜਰਾਤ ਵਿੱਚ ਮੈਨੂੰ ਰਹਿਣਾ ਸਹਿਣਾ ਪਿਆ ਮੈਂ ਉੱਥੇ ਰਹੀ ਮੈਨੂੰ ਵਧੀਆ ਲੱਗਿਆ ਉੱਥੇ ਦਾ ਖਾਣ ਪੀਣ ਬਹੁਤ ਵਧੀਆ ਲੱਗਿਆ ਉਹਨਾਂ ਨੇ ਮੈਨੂੰ ਮਿੱਠਾ ਖਵਾਇਆ ਉਹ ਜ਼ਿਆਦਾਤਰ ਮਿੱਠਾ ਖਾਂਦੇ ਹਾਂ ਅਤੇ ਉੱਥੇ ਮੈਂ ਰਹੀ ਆਪਣਾ ਤਾਂ ਮੈਨੂੰ ਵਧੀਆ ਲੱਗਿਆ ਮੈਨੂੰ ਬੜੀ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਦੋਂ ਮੈਂ ਉੱਥੇ ਗਈ ਤਾਂ ਮੈਂ ਉੱਥੇ ਵੀ ਆਪਣਾ ਪ੍ਰਾਈਜ ਜਿੱਤ ਕੇ ਆਈ ਸੀ ਅਤੇ ਮੈਂ ਉੱਥੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸੀ ਤਾਂ ਸਭ ਨੂੰ ਬਹੁਤ ਵਧੀਆ ਲੱਗਿਆ ਸੀ ਮੇਰਾ ਕਲਾ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਮੈਂ ਬਹੁਤ ਕੁਛ ਨਵਾਂ ਸਿੱਖੀ ਸੀ ਉੱਥੇ ਜਾ ਕੇ ਤਾਂ ਵਧੀਆ ਸੀ ਐਕਸਪੀਰੀਅੰਸ ਧੰਨਵਾਦ